ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਐਕਚੁਲੀ ਮੈਂ ਇੱਕ ਕੰਪਨੀ ਤੋਂ ਗੱਲ ਕਰ ਰਹੀ ਹਾਂ ਏਜੈਂਟ ਔਰ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਸਾਡੇ ਨੌਨ 'ਚ ਆਇਆ ਵੀ ਤੁਸੀਂ ਹੋਲਸੇਲਰ ਦੀ ਤੁਹਾਡੀ ਸ਼ੌਪ ਹੈ ਔਰ ਅਸੀਂ ਇੱਕ ਪ੍ਰੋਡਕਟ ਲਾਂਚ ਕਰਨਾ ਚਾਹੁੰਦੇ ਹਾਂ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਜੇ ਤੁਸੀਂ ਥੋੜ੍ਹੀ ਦੇਰ ਫਰੀ ਹੋ ਤਾਂ ਐਕਚੁਲੀ ਅਸੀਂ ਇੱਕ ਸਕਿੰਨ ਪ੍ਰੋਡਕਟ ਕਰ ਰਹੇ ਹਾਂ ਲਾਂਚ ਜੋ ਕਿ ਅਸੀਂ ਸਾਰੇ ਸ਼ੋਪਸ 'ਤੇ ਸੇਲ ਕਰਨਾ ਫਸਟ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਜੋ ਸਾਡਾ ਸਾਡਾ ਪ੍ਰੋਡਕਟ ਜੋ ਹੈ ਉਹ ਟੂ ਹੰਡਰਡ ਦਾ ਜੋ ਕਿ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਦੇ ਸਕਦੇ ਹਾਂ ਵਨ ਫਿਫਟੀ ਵਿੱਚ ਤਾਂ ਉਹ ਜਦੋਂ ਫਿਫਟੀ ਤੁਹਾਡਾ ਹਰ ਵਿੱਚੋਂ ਕਸਟ ਹਰ ਕਸਟਮਰ ਵਿੱਚੋਂ ਤੁਹਾਡਾ ਕਮੀਸ਼ਨ ਹੋਏਗਾ ਫਿਫਟੀ ਰੁਪੀਸ ਅਗਰ ਸਾਡੀ ਸੇਲ ਜ਼ਿਆਦਾ ਵਧਦੀ ਹੈ ਤਾਂ ਅਸੀਂ ਤੁਹਾਨੂੰ ਹੋਰ ਵੀ ਕਮਿਸ਼ਨ ਦੇ ਸਕਦੇ ਹਾਂ ਜੇ ਤੁਸੀਂ ਸਾਡਾ ਪ੍ਰੋਡਕਟ ਲਾਂਚ ਕਰਨ ਵਿੱਚ ਸਾਡੀ ਹੈਲਪ ਕਰਦੇ ਹੋ ਸਾਡਾ ਜੋ ਪ੍ਰੋਡਕਟ ਹੈ ਉਹ ਵੰਨ ਇਨ ਵਿਦਇਨ ਵਨ ਮੰਥ ਜਾਂ ਟੂ ਮੰਥ 'ਚ ਲਾਂਚ ਹੋ ਸਕ ਤਾਂ ਅਸੀਂ ਤੁਹਾਨੂੰ ਪੁੱਛਣਾ ਚਾਹਵਾਂਗੇ ਕਿ ਤੁਸੀਂ ਪਹਿਲਾਂ ਵੀ ਕਿਸੇ ਨਾਲ ਗੱਲ ਕੀਤੀ ਹੈ ਵੀ ਤੁਸੀਂ ਉਹਨਾਂ ਦੇ ਪ੍ਰੋਡਕਟ ਸੇਲ ਕਰਵਾਏ ਹੈ ਜਾਂ ਨਹੀਂ ਓਕੇ ਤਾਂ ਹੁਣ ਤੁਸੀਂ ਸਾਡੇ ਨਾਲ ਇੱਦਾਂ ਕੰਮ ਕਰਨ ਲਈ ਰੈਡੀ ਹੋ ਜਾਂ ਨਹੀਂ ਓਕੇ ਓਕੇ ਅਤੇ ਫਿਰ ਅਸੀਂ ਤੁਹਾਨੂੰ ਆਪਣੇ ਮਤਲਬ ਪ੍ਰੋਡਕਟ ਦੇਵਾਂਗੇ ਤਾਂ ਤੁਸੀਂ ਸਾਨੂੰ ਕੋਈ ਆਈਡੀਆ ਦੇ ਸਕਦੇ ਹੋ ਕਿ ਤੁਸੀਂ ਸਾਡੀ ਵਨ ਵੀਕ ਵਿੱਚ ਕਿੰਨੀ ਸੇਲ ਕੱਢ ਸਕਦੇ ਹੋ ਹਾਓ ਮਚ ਓਕੇ ਮਤਲਬ ਤੁਸੀਂ ਇੱਕ ਇੱਕ ਵੀਕ ਵਿੱਚ ਕਿੰਨੇ ਪੀਸ ਸੇਲ ਕਰਵਾ ਸਕਦੇ ਹੋ ਓਕੇ ਚਲੋ ਠੀਕ ਹੈ ਕੱਲ੍ਹ ਮਿਲਦੇ ਹਾਂ ਤਾਂ ਫਿਰ ਬੈਠ ਕੇ ਸਾਰੀ ਡੀਲ ਕਰ ਸਕਦੇ ਹਾਂ ਆਪਾਂ ਓਕੇ ਥੈਂਕ ਯੂ